ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖੇਡਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਉਸ ਤਰ੍ਹਾਂ ਦੌੜਨਾ ਜੇਕਰ ਅਸੀਂ ਕੋਈ ਖੇਡ ਵਿੱਚ ਭਾਗ ਲੈਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਅ ਐਕਸਰਸਾਈਜ਼ ਕਰਨੀ ਪੈਂਦੀ ਹੈ ਕਸਰਤ ਕਰਨੀ ਪੈਂਦੀ ਹੈ ਕਸਰਤ ਕਰਨ ਤੋਂ ਪਹਿਲਾਂ ਸਾਨੂੰ ਦੌੜਨਾ ਪੈਂਦਾ ਹੈ ਜੇਕਰ ਅਸੀਂ ਦੌੜਾਂਗੇ ਨਹੀਂ ਤਾਂ ਸਾਡਾ ਸਟੈਮਿਨਾ ਨਹੀਂ ਨਹੀਂ ਬਣੇਗਾ ਜੇ ਸਾਡਾ ਸਟੈਮਿਨਾ ਨਹੀਂ ਬਣੇਗਾ ਫਿਰ ਅਸੀਂ ਕੁਛ ਖੇਡ ਹੀ ਨਹੀਂ ਸਕਦੇ ਤਾਂ ਇਸ ਨਾਲ ਅਸੀਂ ਖੇਡਾਂ ਵਿੱਚ ਭਾਗ ਲੈ ਹੀ ਨਹੀਂ ਸਕਦੇ ਅਤੇ ਸਾਨੂੰ ਦੌੜਨਾ ਚਾਹੀਦਾ ਅ ਸਾਨੂੰ ਦੌੜਨਾ ਖੇਡਾਂ ਲਈ ਬਹੁਤ ਹੀ ਮਹੱਤਵ ਹੈ ਤਾਂ ਸਾਨੂੰ ਸ ਇੱਕ ਦਿਨ ਵਿੱਚ ਘੱਟੋ ਘੱਟ ਇੱਕ ਘੰਟਾ ਤਾਂ ਜ਼ ਦੌੜਨਾ ਜ਼ਰੂਰ ਚਾਹੀਦਾ ਵਿੱਚ ਵਿੱਚ ਥਕਾਵਟ ਦੂਰ ਕਰਨੀ ਚਾਹੀਦੀ ਹੈ ਅਤੇ ਇੱਕ ਘੰਟਾ ਤਾਂ ਸਾਨੂੰ ਆਰਾਮ ਨਾਲ ਦੌੜਨਾ ਚਾਹੀਦਾ ਹੈ ਸਵੇਰ ਦੇ ਸੈਰ ਨਾਲ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਜਿਵੇਂ ਕਿ ਠੰਡ ਆ ਜਦੋਂ ਠੰਡ ਆ ਜਾਂਦੀ ਹੈ ਤਾਂ ਕਈ ਵਾਰ ਤਾਂ ਸਾਨੂੰ ਕਸਰਤ ਕਰਨ ਅਤੇ ਦੌੜਨ ਵਿੱਚ ਆਲਸ ਆਉਂਦੀ ਹੈ ਪਰ ਸਿਹਤ ਮਾਹਿਰ ਹਮੇਸ਼ਾ ਸਿਹਤਮੰਦ ਰਹਿਣ ਲਈ ਹੀ ਕਲੈ ਰਹਿਣ ਲਈ ਕਸਰਤ ਦੀ ਸਲਾਹ ਜ਼ਰੂਰ ਦਿੰਦੇ ਹਨ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ ਇਹ ਹਰ ਇੱਕ ਵਿਅਕਤੀ ਲਈ ਫਾਇਦੇਮੰਦ ਹੈ ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ ਜਿਵੇਂ ਸਹਿਣਸ਼ੀਲਤਾ ਅਨੁਸ਼ਾਸਨ ਸਦਾਚਾਰ ਜਿੱਤਣ ਦੀ ਤਾਂਗ ਆਪਸੀ ਪ੍ਰੇਮ ਪਿਆਰ ਇੱਕਜੁੱਟਤਾ ਸਬਰ ਆਦਿ ਕੁੱਟ ਕੁੱਟ ਕੇ ਭਰ ਦਿੰਦੀਆਂ ਹਨ ਭਾਰ ਘਟਾਉਣ ਜਾਂ ਬਣਾਏ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਕੈਲੋਰੀ ਦੀ ਖਪਤ ਕਰਦਾ ਹੈ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਘੱਟ ਕਰਦਾ ਹੈ ਸ਼ੂਗਰ ਵਿੱਚ ਵੀ ਸੁਧਾਰ ਆਉਂਦਾ ਹੈ ਦਿਲ ਦੀ ਬਿਮਾਰੀਆਂ ਨੂੰ ਵੀ ਘਟਾਉਂਦਾ ਹੈ ਖੇਡਾਂ ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ ਮਨੁੱਖ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਕੋਈ ਨਾ ਕੋਈ ਖੇਡ ਖੇਡਦਾ ਆਇਆ ਹੈ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ ਖੇਡਾਂ ਮਨੋਰੰਜਨ ਅਤੇ ਵੇਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵਧੀਆ ਸਾਧਨ ਹਨ ਖੇਡਾਂ ਮਨੁੱਖ ਲਈ ਓਨੀਆਂ ਹੀ ਜ਼ਰੂਰੀ ਹਨ ਜਿੰਨਾ ਮਨੁੱਖ ਲਈ ਹਵਾ ਅਤੇ ਪਾਣੀ ਇਹ ਮਨੁੱਖ ਦੇ ਸਰਬ ਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਬੱਚੇ ਦੇ ਜਨਮ ਤੋਂ ਲੈ ਕੇ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ ਇਹ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਸ਼ਕਤੀ ਸ਼ਕਤੀਆਂ ਦਿੰਦੀਆਂ ਹਨ ਇਹਨਾਂ ਨਾਲ ਮਨੁੱਖੀ ਜੀਵਨ ਦਾ ਡੂੰਘਾ ਸੰਬੰਧ ਹੈ ਕਿਸੇ ਨੇ ਠੀਕ ਹੀ ਕਿਹਾ ਹੈ ਅਰੋਗ ਸਰੀਰ ਅੰਦਰ ਹੀ ਅਰੋਗ ਮਨ ਨਿਵਾਸ ਕਰਦਾ ਹੈ ਸਿੱਖਣ ਪ੍ਰਕਿਰਿਆ ਛੋਟੇ ਹੁੰਦਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ